ਸਾਡੇ ਪਰਿਵਾਰ ਵਿੱਚ ਬਾਗਬਾਨੀ ਦੇ ਵਿੱਚ ਮੇਰੇ ਤੋਂ ਇਲਾਵਾ ਸਾਰਾ ਪਰਿਵਾਰ ਹੀ ਦਿਲਚਸਪੀ ਰੱਖਦਾ ਬੇਟੇ ਨਵੇਂ ਨਵੇਂ ਪੌਦੇ ਲਿਆ ਕੇ ਘਰ ਬਗੀਚੀ ਬਣਾਈ ਹੋਈ ਉਹਦੇ ਵਿੱਚ ਲਾਉਂਦੇ ਨਾ ਪਾਣੀ ਪਾਉਂਦੇ ਨੇਗੇ ਗੋਡੀ ਕਰਦੇ ਨਾ ਅਤੇ ਹੋਰ ਵੀ ਫੁੱਲਾਂ ਵਾਲੇ ਜਿਹੜੇ ਬੂਟੇ ਲਿਆ ਕੇ ਲਾਉਂਦੇ ਨਗੇ ਅਤੇ ਚਾਰ ਚੁਫੇਰੇ ਉਹਦੇ ਡੈਕੋਰੇਸ਼ਨ ਬਣਾ ਕੇ ਇੱਟਾਂ ਲਾਈਆਂ ਹੋਈਆਂ ਨੇਗੀਆਂ ਅਤੇ ਪੰਛੀਆਂ ਦੇ ਪੀਣ ਵਾਸਤੇ ਪਾਣੀ ਵੀ ਧਰਨੇ ਛੋਟੇ ਛੋਟੇ ਆਲ੍ਹਣੇ ਵੀ ਬਣਾਉਂਦੇ ਨੇਗੇ ਅਤੇ ਸਾਨੂੰ ਇਹਦੇ ਵਿੱਚ ਕੰਮ ਕਰਕੇ ਸਾਰੇ ਪਰਿਵਾਰ ਨੂੰ ਬਹੁਤ ਸਕੂਨ ਮਿਲਦਾ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ ਇਹਦੇ ਲਵੇ ਲਵੇ ਵੇਲ੍ਹਾਂ ਵੀ ਲਾ ਲੈਂਦੇ ਨਗੇ ਉਹ ਵੀ ਦੇਖਣ ਦੇ ਵਿੱਚ ਬਹੁਤ ਵਧੀਆ ਲੱਗ ਜਾਂਦੀਆਂ ਫੁੱਲ ਕੱਢਦੀਆਂ ਨੇਗੀਆਂ ਸੁਬਹਾ ਸ਼ਾਮ ਅਸੀਂ ਇਹਦੇ ਵਿੱਚ ਬਹਿ ਕੇ ਆਨੰਦ ਮਾਣਦੇ ਹਾਂ ਸਾਰਾ ਪਰਿਵਾਰ ਧੰਨਵਾਦ